ਸਤਿ ਸ਼੍ਰੀ ਅਕਾਲ ਮੈਮ ਹਾਂਜੀ ਇੰਸ਼ੋਰੈਂਸ ਦੇ ਕੀ ਕੀ ਫ਼ਾਇਦੇ ਨੇ

ਓਕੇ ਓਕੇ ਓਕੇ ਹੈਲਥ ਹੈਲਥ ਹੈਲਥ ਇੰਸ਼ੋਰੈਂਸ ਬਾਰੇ ਓਕੇ ਸਰ ਜੀ ਇਹਦਾ ਫ਼ਾਇਦਾ ਕੀ ਆ ਤਾਂ ਤੁਸੀਂ ਮੈਨੂੰ ਇੱਦਾਂ ਯਕੀਨ ਕਿਵੇਂ ਦਵਾਓਂਗੇ ਜੀ ਯਕੀਨ ਕਿਵੇਂ ਦਵਾਓਗੇ ਹੈਲਥ ਇੰਸ਼ੋਰੈਂਸ ਦਾ ਓਕੇ ਥੈਂਕਸ ਆ ਮੈਮ ਇੰਨੀ ਇਨਫੋਰਮੇਸ਼ਨ ਦੇਣ ਲਈ ਓਕੇ ਥੈਂਕਸ